ਮੈਂ ਕਬੱਡੀ ਖੇਡ ਬਹੁਤ ਖੇਡੀ ਹੈ ਇਹ ਬਹੁਤ ਸ਼ਾਨਦਾਰ ਹੈ ਕਿਉਂਕਿ ਇਸ ਵਿੱਚ ਇੱਕ ਤਾਂ ਸਰੀਰ ਦੀ ਤੰਦਰੁਸਤੀ ਅਤੇ ਸਰੀਰ ਦਾ ਬਲ ਆਉਂਦਾ ਹੈ ਅਤੇ ਦੂਜੀ ਚੁਸਤੀ ਆਉਂਦੀ ਹੈ